ਵੈਸੇ ਤਾਂ ਪਹਿਲੇ ਪਹਿਲੇ ਤਾਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਸੀ ਇਸੇ ਕਾਰਨ ਛੋਟੇ ਮੋਟੇ ਕਿਸਾਨ ਕਾਫੀ ਹੱਦ ਤੱਕ ਨੁਕਸਾਨ ਵੀ ਦਿੰਦੇ ਅਤੇ ਨਾਲ ਉਹਨਾਂ ਦਾ ਕਾਰੋਬਾਰ ਨਹੀ ਚੱਲਦਾ ਸੀ ਇਸੇ ਕਾਰਨ ਕਿਸਾਨ ਆਪਣੀ ਖੁਦਕੁਸ਼ੀ ਕਰ ਲੈਂਦੇ ਸੀ ਪਰ ਹੁਣ ਕਾਫੀ ਹੱਦ ਤੱਕ ਸਰਕਾਰ ਫੈਸਲਾ ਕਰ ਚੁੱਕੀ ਹੈ ਕਿ ਹੁਣ ਕੋਈ ਵੀ ਕ ਕਿਸਾਨ ਖੁਦਕੁਸ਼ੀ ਨਹੀ ਕਰੇਗਾ ਪਰ ਵੈਸੇ ਤਾਂ ਕ ਸਰਕਾਰ ਨੇ ਕਿਸਾਨਾਂ ਲਈ ਕੈਫੀ ਕਾਫੀ ਸਾਰੀ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਹਨਾਂ ਵਿੱਚ ਕਿਸਾਨ ਆਪਣਾ ਕੁਝ ਚਲਾ ਰਹੇ ਹਨ ਜੈਸੇ ਤਾਂ ਕਿ ਕਿਸਾਨਾਂ ਨੂੰ ਬੁਢਾਪਾ ਪੈਨਸ਼ਨ ਆਦਿ ਕਿਸਾਨਾਂ ਦੇ ਬਾਰੇ ਔਰ ਕਈ ਚੀਜ਼ਾਂ ਮੁਫਤ ਵਿੱਚ ਰਾਸ਼ਨ ਪਾਣੀ ਵਗੈਰਾ ਮੁਫਤ ਮਿਲਿਆ ਹੈ ਉਹਨਾਂ ਨੂੰ ਬਿਜਲੀ ਵੀ ਮੁਫਤ ਮਿਲੀ ਹੈ ਅਤੇ ਹੋਰ ਕਈ ਜਗ੍ਹਾ ਪਾਣੀ ਸੁਵਿਧਾਵਾਂ ਸਾਰੀਆਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਇਸੇ ਕਾਰਨ ਕਿਸਾਨ ਪਹਿਲੇ ਜ਼ਮਾਨੇ ਵਿੱਚ ਆਪਣੀ ਖੁਦਕੁਸ਼ੀ ਕਰ ਲੈਂਦੇ ਹੁਣ ਦੇ ਜ਼ਮਾਨੇ ਵਿੱਚ ਕਿਸਾਨ ਆਪਣੇ ਚੰਗੇ ਜੀਵਨ 'ਚ ਜੀਅ ਰਹੇ ਹਨ ਧੰਨਵਾਦ